ਮੇਰਾ ਇਲਾਕਾ ਫਤਿਹਗੜ੍ਹ ਸਾਹਿਬ ਸਰਹਿੰਦ ਵਿਖੇ ਐਨ ਕਾਫੀ ਥਾਵਾਂ ਤਾਂ ਨਹੀਂ ਯਾਤਰਾ ਕਰਨ ਲਈ ਪਰ ਇੱਕ ਆਮ ਖਾਸ ਬਾਗ ਦੀਵਾਨ ਟੋਡਰ ਮੱਲ ਵਾਲੀ ਸਾਈਡ ਕਾਫੀ ਕੁਛ ਹੈ ਜੋ ਦੇਖਣ ਵਾਲਾ ਹੈ ਲੋਕ ਅੱਜ ਕੱਲ੍ਹ ਹਰਿਆਲੀ ਲੈਣ ਵਾਸਤੇ ਇੱਥੇ ਆਉਂਦੇ ਹੈ ਆਪਣੇ ਪਰਿਵਾਰ ਸਮੇਤ ਅਗਰ ਯਾਤਰਾ ਦੀ ਗੱਲ ਕਰੀਏ ਯਾਤਰਾ ਵੇਲੇ ਸਭ ਤੋਂ ਵੱਡੀ ਸਥਾਨ ਜੋ ਕਿ ਫਤਿਹਗੜ੍ਹ ਸਾਹਿਬ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਸੀ ਅਤੇ ਉਹਨਾਂ ਦੀ ਸ਼ਹੀਦੀ ਹੋਈ ਸੀ

ਅੱਜ ਕੱਲ੍ਹ ਲੋਕ ਸਭਾ ਵਾਲੇ ਦਿਨਾਂ ਵਿੱਚ ਦਸੰਬਰ ਦੇ ਮਹੀਨੇ ਵਿੱਚ ਉਹ ਇੱਥੇ ਆਉਣਾ ਪਸੰਦ ਕਰਦੇ ਹਨ ਅਤੇ ਉਹਨਾਂ ਦੀ ਸਾਰਾ ਉਹਨਾਂ ਦਾ ਸਾਰਾ ਇਤਿਹਾਸ ਦੇਖਣਾ ਚਾਹੁੰਦੇ ਹਨ ਆਮ ਖਾਸ ਬਾਗ ਜੋ ਕਿ ਸਰਹਿੰਦ ਵਿਖੇ ਹੈ ਫਤਿਹਗੜ੍ਹ ਸਾਹਿਬ ਵਿਖੇ ਹੈ ਲੋਕ ਪਰਿਵਾਰ ਸਮੇਤ ਇੱਥੇ ਆਉਂਦੇ ਹਨ ਦੇਖਣ ਵਾਸਤੇ ਜਿਵੇਂ ਕਿ ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਹੈ ਉਵੇਂ ਹੀ ਇੱਥੇ ਇਹ ਵੀ ਬਾਗ ਹੀ ਹੈ ਅਤੇ ਉਹ ਇੱਥੇ ਆਉਂਦੇ ਹਨ ਅਤੇ ਹੋਰ ਵੀ ਕਾਫੀ ਕੁਛ ਹੈ ਇੱਥੇ ਦੇਖਣ ਵਾਲਾ ਜੋ ਸ਼ਾਮ ਦੇ ਵੇਲੇ ਕੁਦਰਤ ਨੂੰ ਵਧੀਆ ਕੁਦਰਤ ਨੂੰ ਆਪਾਂ ਦੇਖ ਸਕਦੇ ਹਾਂ ਅਤੇ ਆਪਾਂ ਨੂੰ ਵਧੀਆ ਲੱਗੇਗਾ